ਤਰਨ ਤਾਰਨ ਜ਼ਿਲ੍ਹੇ ਵਿੱਚ ਮੌਸਮ ਕਦੇ ਠੰਡਾ ਕਦੇ ਗਰਮ ਕਦੇ ਦਰਮਿਆਨਾ ਹੁੰਦਾ ਹੈ ਸਾਡੇ 'ਤੇ ਇਸ ਦਾ ਬਹੁਤ ਅਸਰ ਪੈਂਦਾ ਹੈ ਜ਼ਿਆਦਾਤਰ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਮੌਸਮ ਬਹੁਤ ਠੰਡਾ ਰਹਿੰਦਾ ਹੈ ਕਦੇ ਕਦੇ ਤਾਂ ਇੰਨੀ ਧੁੰਦ ਪੈਂਦੀ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਆਏ ਦਿਨ ਐਕਸੀਡੈਂਟ ਦੇ ਕੇਸ ਹੁੰਦੇ ਰਹਿੰਦੇ ਹਨ ਜ਼ਿਆਦਾ ਠੰਡ ਵੀ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਨਾ ਤਾਂ ਬੱਚੇ ਸਕੂਲ ਜਾ ਪਾਉਂਦੇ ਹਨ ਅਤੇ ਨਾ ਹੀ ਕੋਈ ਕੰਮ ਕਾਰ ਹੁੰਦਾ ਹੈ ਮਾਰਚ ਤੋਂ ਲੈ ਕੇ ਅਗਸਤ ਤੱਕ ਮੌਸਮ ਬਹੁਤ ਗਰਮ ਹੁੰਦਾ ਹੈ ਸਤੰਬਰ ਅਤੇ ਅਕਤੂਬਰ ਦਾ ਮੌਸਮ ਨਾ ਜ਼ਿਆਦਾ ਠੰਡਾ ਹੁੰਦਾ ਹੈ ਅਤੇ ਨਾ ਹੀ ਜ਼ਿਆਦਾ ਗਰਮ ਹੁੰਦਾ ਹੈ ਦੁਪਹਿਰੇ ਕੌਟਨ ਦੇ ਕੱਪੜੇ ਪਾਉਣੇ ਪੈਂਦੇ ਨੇ ਤੇ ਅਤੇ ਰਾਤ ਨੂੰ ਫੁੱਲ ਸਲੀਵ ਕੱਪੜੇ ਪਾਉਣੇ ਪੈਂਦੇ ਨੇ ਮਾਰਚ ਤੋਂ ਅਗਸਤ ਤੱਕ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਦਿਨ ਦੇ ਵੇਲੇ ਸੂਰਜ ਦੀ ਤਪਸ਼ ਬਹੁਤ ਜ਼ਿਆਦਾ ਹੁੰਦੀ ਹੈ ਜੂਨ ਜੁਲਾਈ ਵਿੱਚ ਬਹੁਤ ਬਰਸਾਤਾਂ ਹੁੰਦੀਆਂ ਹਨ ਜ਼ਿਆਦਾ ਬਰਸਾਤਾਂ ਦੇ ਕਾਰਣ ਕਈ ਵਾਰ ਤਾਂ ਹੜ੍ਹ ਆ ਜਾਂਦੇ ਹਨ ਲੋਕਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ ਬਰਸਾਤਾਂ ਦਾ ਲੋਕਾਂ ਦੇ ਜੀਵਨ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਤਰਨ ਤਾਰਨ ਵਿੱਚ ਸਾਰਾ ਸਾਲ ਹੀ ਮੌਸਮ ਆਪਣੀ ਮਿਜਾਜ਼ ਬਦਲਦਾ ਰਹਿੰਦਾ ਹੈ ਕਦੇ ਬਹੁਤ ਗਰਮ ਕਦੇ ਦਰਮਿਆਨਾ ਕਦੇ ਬਹੁਤ ਬਰਸਾਤਾਂ ਕਦੇ ਬਹੁਤ ਸਰਦੀ ਹਰ ਮੌਸਮ ਆਪਣੀ ਬਦਲਦੀ ਮਿਜ਼ਾਜ ਦੇ ਨਾਲ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਧੰਨਵਾਦ